ਕੀ ਤੁਸੀਂ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦੇ ਹੋ ਕਿ ਭੰਗੜਾ ਸਿਰਫ ਪੰਜਾਬ ਵਿੱਚ ਹੀ ਪ੍ਰਚਲਿਤ ਹੈ ਜਾਂ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਭੰਗੜਾ ਅੱਜ ਜੋ ਅੱਜ ਦਾ ਜ਼ਮਾਨਾ ਹੈ ਤਾਂ ਉਸ ਦੌਰ ਦੇ ਵਿੱਚ ਭੰਗੜਾ ਸਿਰਫ ਪੰਜਾਬ ਤੱਕ ਸੀਮਤ ਨਾ ਰਹਿ ਕੇ ਦੁਨੀਆਂ ਭਰ ਵਿੱਚ ਪੂਰੇ ਦੇਸ਼ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈਗਾ ਇਸ ਦੀ ਮਹੱਤਤਾ ਜਾਂ ਪਿਛੋਕੜ ਬਾਰੇ ਥੋੜ੍ਹਾ ਗੱਲਬਾਤ ਕਰੀਏ ਤਾਂ ਇਸ ਦਾ ਪਿਛੋਕੜ ਪੂਰੇ ਪੰਜਾਬ ਤੋਂ ਹੈ ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਨੂੰ ਜਦੋਂ ਕਣਕ ਦੀ ਵਾਢੀ ਆਉਂਦੀ ਆ ਅਤੇ ਲੋਕ ਖੁਸ਼ੀ ਵਿੱਚ ਵੀ ਸਾਡੀ ਫਸਲ ਪੱਕ ਗਈ ਤਾਂ ਉਸ ਖੁਸ਼ੀ ਵਿੱਚ ਭੰਗੜਾ ਪਾਉਂਦੇ ਸੀਗੇ ਅਤੇ ਜਾਂ ਫਿਰ ਭੰਗੜਾ ਇੱਕ ਮਰਦਾਂ ਦਾ ਲੋਕ ਨਾਚ ਹੈਗਾ ਤਾਂ ਉਸ ਵਕਤ ਇਹ ਵਿਆਹ ਸ਼ਾਦੀਆਂ ਦੇ ਮੌਕਿਆਂ 'ਤੇ ਪਾਇਆ ਜਾਂਦਾ ਹੈਗਾ ਤਾਂ ਹਰ ਇੱਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਫਿਰ ਅੱਜ ਕੱਲ੍ਹ ਪੰਜਾਬੀ ਨੇ ਜਿਹੜੇ ਬਾਹਰਲੇ ਦੇਸ਼ਾਂ ਤੱਕ ਜਾ ਵਸੇ ਹਨ ਇਸ ਕਰਕੇ ਸਿਰਫ ਪੰਜਾਬ ਤੱਕ ਸੀਮਤ ਨਾ ਹੋ ਕੇ ਬਾਹਰਲੇ ਦੇਸ਼ਾਂ ਪ੍ਰਦੇਸ਼ਾਂ ਤੱਕ ਵੀ ਪਹੁੰਚ ਗਿਆ ਹੈ ਅਤੇ ਅੱਜ ਕੱਲ੍ਹ ਆਧੁਨਿਕ ਜਿਹੜੇ ਭੰਗੜੇ ਦੇ ਕੋਲ ਸੀਗੇ ਸਾਡੇ ਪੁਰਾਤਨ ਬਜ਼ੁਰਗ ਉਹ ਅਲੋਪ ਹੋ ਰਹੇ ਨੇ ਹੌਲੀ ਹੌਲੀ ਇਹ ਅਲੋਪ ਹੁੰਦਾ ਜਾ ਰਿਹਾ ਹੈਗਾ ਪਰ ਇਸਦੇ ਨਾਲ ਕਈ ਅਕੈਡਮੀਆਂ ਵਾਲੇ ਜਾਂ ਕੋਚ ਇਸ ਦੀ ਤਿਆਰੀ ਕਰਵਾ ਦਿੰਦੇ ਹਨ ਅਤੇ ਇਸਦੇ ਕਈ ਕੰਪਟੀਸ਼ਨ ਵੀ ਹੁੰਦੇ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਇਸ ਵਿੱਚ ਹਿੱਸੇ ਲਏ ਜਾਂਦੇ ਹਨ ਅਤੇ ਕਾਲਜ ਦੀਆਂ ਜੋ ਟੀਮਾਂ ਹੁੰਦੀਆਂ ਨੇ ਇੰਟਰ ਜੋਨ ਜਾਂ ਇੰਟਰ ਕੋਲਜ ਉਹਨਾਂ ਦੇ ਵਿੱਚ ਵੀ ਇਹ ਇਹਨਾਂ ਦਾ ਹਿੱਸਾ ਜੋ ਹੈ ਉਹ ਲਿਆ ਜਾਂਦਾ ਹੈ ਤਾਂ ਜੋਨਲ ਫੈਸਟੀਵਲ ਹੁੰਦੇ ਨੇ ਉਹਨਾਂ ਵਿੱਚ ਵੀ ਅਲੱਗ ਅਲੱਗ ਕਾਲਜਾਂ ਦੇ ਜਿਹੜੇ ਭੰਗੜੇ ਦੀਆਂ ਟੀਮਾਂ ਹੁੰਦੀਆਂ ਨੇਗੀਆਂ ਉਹ ਆਉਂਦੀਆਂ ਹਨ ਅਤੇ ਉਸ ਮੁਤਾਬਿਕ ਹਿੱਸਾ ਲੈਂਦੀਆਂ ਹਨ ਜੋ ਬੈਸਟ ਟੀਮ ਹੁੰਦੀ ਆ ਉਹਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਇਸਦੀ ਬਹੁਤ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਅਤੇ ਇਸ ਦੀ ਮਹੱਤਤਾ ਬਾਰੇ ਜਾਣੀਏ ਤਾਂ ਇੱਕ ਇੱਕ ਅਧੂਨੀ ਸੌਂਕ ਜਦੋਂ ਕਿ ਮਰਦ ਭੰਗੜਾ ਪਾਉਂਦਾ ਹੈ ਜਾਂ ਢੋਲ ਦੀ ਦਾਬ 'ਤੇ ਨੱਚਦਾ ਹੈ ਤਾਂ ਉਸਦੇ ਅੰਦਰੋਂ ਖੁਸ਼ੀ ਝਲਕਦੀ ਹੈ ਤਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਗਾ ਇਸ ਤਰ੍ਹਾਂ ਜਿਹੜਾ ਉਸਦਾ ਮਨ ਹੈਗਾ ਉਹ ਖੁਸ਼ ਹੋ ਜਾਂਦਾ ਹੈ ਅਤੇ ਬੇਸ਼ੱਕ ਜਦੋਂ ਆਪਾਂ ਦੇਖਦੇ ਹਾਂ ਭੰਗੜੇ ਦਾ ਕਿਸੇ ਆਪਾਂ ਹੋਰ ਮੂੜ 'ਚ ਬੈਠੇ ਹੋਈਏ ਜਾਂ ਆਪਾਂ ਕਿਸੇ ਵੀ ਇੱਧਰ ਉੱਧਰ ਧਿਆਨ ਨਾ ਹੋਵੇ ਜਾਂ ਸਾਡਾ ਮੂਡ ਆਫ ਹੋਵੇ ਤਾਂ ਅਸੀਂ ਭੰਗੜਾ ਲੋਕ ਨਾਚ ਕਰਦੇ ਹੈਗੇ ਤਾਂ ਸਾਡਾ ਆਪਣੇ ਆਪ ਖੁਸ਼ੀ ਪ੍ਰਗਟਾਵਾ ਹੋ ਜਾਂਦਾ ਹੈਗਾ ਅਤੇ ਕਈ ਵਾਰ ਜਦੋਂ ਜਿਸ ਬੰਦੇ ਨੂੰ ਭੰਗੜਾ ਆਉਂਦਾ ਗਾ ਮਰਦਾਂ ਨੂੰ ਲੋਕ ਨਾਚ ਆਉਂਦਾ ਗਾ ਤਾਂ ਜਦੋਂ ਸਾਹਮਣੇ ਵਾਲਾ ਭੰਗੜਾ ਪਾਉਂਦਾ ਗਾ ਅਤੇ ਉਸ ਵਕਤ ਤਾਂ ਉਹਦਾ ਪੈਰ ਅੱਡੀ ਨਹੀਂ ਰਹਿੰਦੀ ਉਹ ਆਪਣੇ ਆਪ ਭੰਗੜਾ ਪਾਉਣਾ ਕਹਿੰਦਾ ਅੱਜ ਕੱਲ੍ਹ ਇਸਦਾ ਰੂਪ ਬਦਲ ਰਿਹਾ ਗਾ ਇਸਦੀ ਥਾਂ ਡੀਜਿਆਂ ਨੇ ਲੈ ਲਈ ਹੈ ਅਤੇ ਡੀਜੇ ਲੋਕ ਨਾਚ ਉੱਪਰ ਭੰਗੜਾ ਪਾਇਆ ਜਾਣ ਲੱਗ ਪਿਆ ਹੈ ਇਸ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੈ ਜੀ